ਯੋਗਾ ਇੱਕ ਐਸੀ ਚੀਜ਼ ਹੈ ਜੋ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਯੋਗਾ ਨਾਲ ਅਸੀਂ ਕੁੱਛ ਵੀ ਕਰ ਸਕਦੇ ਹਾਂ ਜੇਕਰ ਅਸੀਂ ਰੋਜ਼ਾਨਾ ਯੋਗਾ ਕਰੀਏ ਤਾਂ ਫਿਰ ਸਾਡੀ ਸਿਹਤ ਵਿੱਚ ਬਹੁਤ ਹੀ ਜ਼ਿਆਦਾ ਬਦਲਾਅ ਆ ਸਕਦਾ ਹੈ ਜੇਕਰ ਸਾਨੂੰ ਸਾਹ ਦੀ ਬਿਮਾਰੀ ਹੈ ਜਾਂ ਫਿਰ ਸਾਨੂੰ ਦਿਲ ਦੀ ਬਿਮਾਰੀ ਹੈ ਤਾਂ ਯੋਗ ਨਾਲ ਉਹ ਸਾਰੀ ਬਿਮਾਰੀ ਦੂਰ ਹੋ ਸਕਦੀ ਹੈ ਅਤੇ ਅਸੀਂ ਬਹੁਤ ਹੀ ਸੁਖਦਾਇਕ ਜ਼ਿੰਦਗੀ ਜੀ ਸਕਦੇ ਹਾਂ ਸਾਨੂੰ ਸਾਰਿਆਂ ਨੂੰ ਯੋਗਾ ਕਰਨਾ ਚਾਹੀਦਾ ਹੈ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਸਵੇਰੇ ਰੋਜ਼ ਤੜਕੇ ਉੱਠ ਕੇ ਯੋਗਾ ਕਰਨਾ ਚਾਹੀਦਾ ਹੈ ਯੋਗੇ ਵਿੱਚ ਬਹੁਤ ਸਾਰੇ ਆਸਣ ਆਉਂਦੇ ਹਨ ਜਿਵੇਂ ਢੱਡ ਆਸਣ ਵੇਦ ਆਸਣ ਸਾਹ ਆਸਣ ਆਦਿ ਅਲੱਗ ਅਲੱਗ ਯੋਗੇ ਨਾਲ ਅਲੱਗ ਅਲੱਗ ਲਾਭ ਹਨ ਯੋਗਾ ਇੱਕ ਐਸੀ ਚੀਜ਼ ਹੈ ਜਿਸ ਦਾ ਕੋਈ ਨੁਕਸਾਨ ਨਹੀਂ ਪਰ ਜੇਕਰ ਅਸੀਂ ਸਹੀ ਤਰੀਕੇ ਨਾਲ ਉਸਨੂੰ ਕਰੀਏ ਯੋਗਾ ਹਰ ਇੱਕ ਬੰਦੇ ਲਈ ਅਵਨ ਆਵਸ਼ਕ ਹੈ ਯੋਗਾ ਸਾਨੂੰ ਸਾਰਿਆਂ ਨੂੰ ਇਹ ਸਿਖਾਉਂਦਾ ਹੈ ਕਿ ਸਾਨੂੰ ਜ਼ਿੰਦਗੀ ਕਿਵੇਂ ਡਿਸਿਪਲਨ 'ਚ ਜੀਣੀ ਚਾਹੀਦਾ ਹੈ ਯੋਗ ਦਾ ਅਭਿਆਸ ਕਰਨ ਤੋਂ ਬਾਅਦ ਸਾਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਹਨ ਸਾਡੀ ਸਰੀਰਿਕ ਅਤੇ ਮਾਨਸਰਿਕ ਤੌਰ ਠੀਕ ਹੋ ਸਕਦੀ ਹੈ ਸਾਨੂੰ ਕੋਈ ਅੱਗੇ ਦਾ ਸਟਰੈਸ ਨਹੀਂ ਹੋ ਸਕਦਾ ਸਾਡੀ ਪੂਰੀ ਦਿਨ ਚਰਿਆ ਵੀ ਬਦਲ ਸਕਦੀ ਹੈ ਯੋਗਾ ਨਾਲ ਤੁਸੀਂ ਆਪਣੀ ਜਿੰਦਗੀ ਦੇ ਦੋ ਸਾਲ ਹੋਰ ਵਧਾ ਸਕਦੇ ਹੋ ਅਤੇ ਤੁਸੀਂ ਇੱਕ ਡਿਸਿਪਲਡ ਲਾਈਫ ਸੈੱਟ ਜੀ ਕ ਜੀ ਸਕਦੇ ਹੋ ਯੋਗ ਹੈ ਤੋ ਹੈ ਕਿਉਂਕਿ ਬਾਬਾ ਰਾਮਦੇਵ ਜੀ ਇ ਇਹ ਕਹਿੰਦੇ ਹਨ ਕੇ ਅਗਰ ਜੇ ਅਸੀਂ ਰੋਜ਼ ਯੋਗਾ ਕਰੀਏ ਤਾਂ ਅਸੀਂ ਰੋਜ਼ ਸੁਖਦਾਇਕ ਜਿੰਦਗੀ ਜੀ ਸਕਦੇ ਹਾਂ ਧੰਨਵਾਦ